ਰਾਜ ਸਿਹਤ ਸਹੂਲਤਾਂ ਵਿੱਚ ਭੀੜ ਭੜੱਕੇ ਦੀ ਸਮੱਸਿਆ ਨੂੰ ਅਸੀਂ ਹੱਲ ਕਰ ਸਕਦੇ ਹਾਂ ਇਸ ਲਈ ਇਸ ਦੀ ਸਾਡੀ ਜ਼ਿੰਮੇਵਾਰੀ ਅਤੇ ਸਿਹਤ ਸਹੂਲਤਾਂ ਦੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਸਿਹਤ ਸਹੂਲਤਾਂ ਦੇ ਪ੍ਰਬੰਧਕਾਂ ਨੂੰ ਵੱਖ ਵੱਖ ਇਲਾਜ ਦੇ ਦਵਾਈਆਂ ਦੇ ਵੱਖ ਵੱਖ ਕੇਂਦਰ ਬਣਾਉਣੇ ਚਾਹੀਦੇ ਹਨ ਤਾਂ ਕਿ ਰਾਜ ਸਿਹਤ ਸਹੂਲਤਾਂ ਵਿੱਚ ਕਿਸੇ ਵੀ ਨਾਗਰਿਕ ਨੂੰ ਕੋਈ ਸਮੱਸਿਆ ਨਾ ਆਵੇ ਅਤੇ ਹਰ ਕੋਈ ਆਪਣੀ ਦਵਾਈ ਨੂੰ ਲੈਣ ਲਈ ਆ ਸਕੇ